ਰਸੋਈ ਵਿੱਚ ਆਮ ਤੌਰ 'ਤੇ ਵਰਤੇ ਜਾਣ ਵਾਲੇ ਬਰਤਨ ਕੁਝ ਇਸ ਪ੍ਰਕਾਰ ਹਨ ਪਲੇਟ ਕੌਲੀ ਬਾਟੀ ਚਮਚਾ ਗਲਾਸ ਥਾਲ ਪ੍ਰਾਂਤ ਚੱਕਲਾ ਵੇਲ੍ਹਣਾ ਕੜਾਈਆ ਜੱਗ ਕੂਕਰ ਕੜਛੀ ਦੇਗਾ ਚਿਮਟਾ ਚਾਹ ਪੁਣਨੀ ਮਰਤਬਾਨ ਇਹਨਾਂ ਦੇ ਕੰਮ ਲੜੀਵਾਰ ਹਨ ਪਲੇਟ ਪਲੇਟ ਵਿੱਚ ਅਸੀਂ ਰੋਟੀ ਖਾਂਦੇ ਹਾਂ ਪਲੇਟ ਵਿੱਚ ਜੇ ਕੁਛ ਰੱਖਣਾ ਹੋਵੇ ਤਾਂ ਰੱਖਿਆ ਜਾਂਦਾ ਹੈ ਜਿਵੇਂ ਰੋਟੀ ਖੀਰ ਆਦਿ ਕੌਲੀ ਕੌਲੀ ਇੱਕ ਛੋਟੀ ਬਾਟੀ ਦੀ ਤਰ੍ਹਾਂ ਹੁੰਦੀ ਹੈ ਜਿਸ ਨੂੰ ਕਿ ਡੁੰਘਾਈ ਵਿੱਚ ਬਣਾਇਆ ਜਾਂਦਾ ਹੈ ਇਹ ਇਸ ਵਿੱਚ ਸਬਜ਼ੀ ਕੋਈ ਖਾਣ ਲਈ ਮਿੱਠੀ ਚੀਜ਼ ਪਾਈ ਜਾ ਸਕਦੀ ਹੈ ਬਾਟੀ ਬਾਟੀ ਕੌਲੀ ਦਾ ਹੀ ਵੱਡਾ ਰੂਪ ਹੈ ਬਾਟੀ ਵਿੱਚ ਵੀ ਅਸੀਂ ਸਬਜ਼ੀ ਖੀਰ ਕੜਾਹ ਆਦਿ ਪਾ ਸਕਦੇ ਹਾਂ ਚਮਚ ਚਮਚ ਕਿਸੇ ਵੀ ਚੀਜ਼ ਨੂੰ ਖਾਣ ਲਈ ਬਣਾਇਆ ਹੋਇਆ ਹੈ ਇਸ ਨਾਲ ਕਿਸੇ ਚੀਜ਼ ਨੂੰ ਚੱਕਣਾ ਸੌਖਾ ਹੋ ਜਾਂਦਾ ਹੈ ਜਿਸ ਕਰਕੇ ਹੱਥ ਵੀ ਨਹੀਂ ਲਿੱਬੜਦੇ ਅਤੇ ਖਾਣਾ ਵੀ ਸੌਖਾ ਹੁੰਦਾ ਹੈ ਜਦੋਂ ਕੋਈ ਚੀਜ਼ ਗਰਮ ਹੋਵੇ ਤਾਂ ਚਮਚੇ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਗਲਾਸ ਗਲਾਸ ਇੱਕ ਲੰਬਾ ਇੱਕ ਬਰਤਨ ਹੁੰਦਾ ਹੈ ਜਿਸ ਵਿੱਚ ਅਸੀਂ ਪਾਣੀ ਪੀਂਦੇ ਹਾਂ ਪਾਣੀ ਜਾਂ ਦੁੱਧ ਲੱਸੀ ਆਦਿ ਇਸ ਵਿੱਚ ਪਾਇਆ ਜਾ ਸਕਦਾ ਹੈ ਥਾਲ ਥਾਲ ਪਲੇਟ ਦਾ ਹੀ ਇੱਕ ਵੱਡਾ ਰੂਪ ਹੈ ਜੋ ਕਿ ਇਸ ਨਾਲੋਂ ਵੱਡਾ ਹੁੰਦਾ ਹੈ ਇਸ ਵਿੱਚ ਕੌਲੀ ਬਾਟੀ ਰੱਖਣ ਲਈ ਵੀ ਜਗ੍ਹਾ ਖੁੱਲ੍ਹੀ ਹੁੰਦੀ ਹੈ ਕਈ ਵਾਰ ਥਾਲ ਵਿੱਚ ਆਪਣੇ ਹੀ ਛੋਟੇ ਛੋਟੇ ਟੋਏ ਬਣਾਏ ਹੁੰਦੇ ਹਨ ਜਿਹਨਾਂ ਵਿੱਚ ਸਬਜ਼ੀ ਮਿੱਠਾ ਆਦਿ ਪੈ ਜਾਂਦਾ ਹੈ ਪ੍ਰਾਂਤ ਪ੍ਰਾਂਤ ਜੋ ਹੈ ਇਸ ਵਿੱਚ ਅਸੀਂ ਆਟਾ ਗੁੰਨਦੇ ਹਾਂ ਆਟਾ ਗੁੰਨਣ ਲਈ ਮੁੱਕੀ ਦਿੱਤੀ ਜਾਂਦੀ ਹੈ ਚੱਕਲਾ ਅਤੇ ਵੇਲਣਾ ਚੱਕਲਾ ਵੇਲਣਾ ਇੱਕ ਜੋਟੀ ਹੈ ਜਿਸ ਨਾਲ ਕਿ ਆਟਾ ਜੋ ਕਿ ਗੁੰਨਿਆ ਹੋਇਆ ਹੈ ਉਸ ਨੂੰ ਵੇਲਿਆ ਜਾਂਦਾ ਹੈ ਅਤੇ ਰੋਟੀ ਨੂੰ ਗੋਲ ਬਣਾਇਆ ਜਾਂਦਾ ਹੈ ਫਿਰ ਆਉਂਦਾ ਹੈ ਤਵਾ ਤਵੇ ਉੱਪਰ ਵੇਲੀ ਹੋਈ ਰੋਟੀ ਪਾ ਕੇ ਉਸ ਨੂੰ ਸੇਕਿਆ ਜਾਂਦਾ ਹੈ ਕੜਾਈਆ ਕੜਾਈਏ ਵਿੱਚ ਅਸੀਂ ਸੁੱਕੀ ਸਬਜ਼ੀ ਜਾਂ ਕੋਈ ਹਲਵੇ ਕੜਾਹ ਆਦਿ ਬਣਾ ਸਕਦੇ ਹਾਂ ਕੂਕਰ ਕੂਕਰ ਵਿੱਚ ਅਸੀਂ ਜੇ ਕੁਛ ਬਣਾਉਣਾ ਹੈ ਤਾਂ ਉਹ ਜਲਦੀ ਬਣ ਜਾਂਦਾ ਹੈ ਇਹ ਵੀ ਸਬਜ਼ੀਆਂ ਆਦਿ ਬਣਾਉਣ ਲਈ ਵਰਤਿਆ ਜਾਂਦਾ ਹੈ ਕੜਛੀ ਕੜਛੀ ਚਮਚੇ ਦਾ ਬਹੁਤ ਵੱਡਾ ਰੂਪ ਹੈ ਜੋ ਕਿ ਸਬਜੀ ਗਰਮ ਨੂੰ ਹਿਲਾਇਆ ਜਾਣ ਲਈ ਹੀ ਬਣਾਇਆ ਗਿਆ ਹੈ ਜਾਂ ਕਿ ਭਾਂਡਿਆਂ ਦੇ ਵਿੱਚ ਵਰਤਾਉਣ ਲਈ ਦੇਗਾ ਦੇਗਾ ਇੱਕ ਵੱਡਾ ਕੜਾਈਆ ਹੁੰਦਾ ਹੈ ਜਿਸ ਵਿੱਚ ਕਿ ਅਸੀਂ ਕੁਝ ਮਿੱਠਾ ਜਾਂ ਸਬਜ਼ੀ ਆਦਿ ਬਣਾ ਸਕਦੇ ਹਾਂ ਚਿਮਟਾ ਚਿਮਟਾ ਬਣੀ ਹੋਈ ਗਰਮ ਰੋਟੀ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਚੱਕਣ ਲਈ ਬਣਾਇਆ ਹੋਇਆ ਇੱਕ ਸ ਬਰਤਨ ਹੈ ਚਾਹ ਪੁਣਨੀ ਚਾਹ ਪੁੁਣਨੀ ਜੋ ਹੈ ਇਸ ਵਿੱਚ ਅਸੀਂ ਚਾਹ ਨੂੰ ਪੁਣ ਲੈਂਦੇ ਹਾਂ ਇਸ ਨਾਲ ਚਾਹ ਪੱਤੀ ਜੋ ਪਾਈ ਹੁੰਦੀ ਹੈ ਉਹ ਅਲੱਗ ਹੋ ਜਾਂਦੀ ਹੈ ਮਰਤਬਾਨ ਮਰਤਬਾਨ ਇੱਕ ਇਸ ਤਰ੍ਹਾਂ ਦੇ ਬਰਤਨ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਅਸੀਂ ਆਪਣੇ ਸਮਾਨ ਨੂੰ ਸਟੋਰ ਕਰਕੇ ਰੱਖਦੇ ਹਾਂ ਜਿਵੇਂ ਕਿ ਆਚਾਰ ਖੰਡ ਚਾਹ ਪੱਤੀ ਆਦਿ